ਸਮੇਂ ਦੇ ਨਾਲ ਪੰਜਾਬੀ ਭਾਸ਼ਾ ਬਹੁਤ ਵਿਕਸਿਤ ਹੋਈ ਆ ਜਿਵੇਂ ਆਪਾਂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਕੀ ਆ ਇੱਕ ਪੱਤੀ ਦੇ ਵਿੱਚ ਲਿਖੀ ਜਾਂਦੀ ਸੀ ਜਿਹੜੀ ਪੰਜਾਬੀ ਬੋਲੀ ਹੈਗੀ ਵੀ ਇੱਕ ਹਜ਼ਾਰ ਸਦੀ ਦੇ ਉਹ ਤੋਂ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਆਪਣੇ ਜਿਹੜੇ ਪੁਰਾਣੇ ਜਿਹੜੇ ਆਪਾਂ ਕਹਿ ਦਈਏ ਜਿਵੇਂ ਸੀਗੇ ਫਕੀਰ ਸੀਗੇ ਹੈ ਨਾ ਜਿਹੜੇ ਲਿਖਦੇ ਸੀ ਹੱਥੀਂ ਹੈ ਨਾ ਵੀ ਜਿਵੇਂ ਬਾਬਾ ਫਰੀਦ ਵਰਗੇ ਬੁੱਲੇ ਸ਼ਾਹ ਵਰਗੇ ਹੋ ਗਏ ਹੈ ਨਾ ਤਾਂ ਵੀ ਉਹ ਉਹਨਾਂ ਸਮਿਆਂ ਦੇ ਵਿੱਚ ਕੀ ਸੀਗਾ ਪੱਤੀ ਦੇ ਵਿੱਚ ਲਿਖੀ ਜਾਂਦੀ ਸੀਗੀ ਅਤੇ ਫਿਰ ਬਹੁਤ ਸਾਰੇ ਵਿਦਵਾਨ ਹੋਏ ਹੌਲੀ ਹੌਲੀ ਹੈ ਨਾ ਉਹਨਾਂ ਨੇ ਨਵੇਂ ਨਵੇਂ ਵਿਚਾਰ ਜਿਹੜੇ ਸ਼ਬਦ ਨੇ ਇਹਦੇ ਵਿੱਚ ਨਾ ਵੀ ਜੋੜੀ ਗਏ ਹੈ ਨਾ ਤਾਂ ਨਵਾਂ ਹੌਲੀ ਹੌਲੀ ਨਵੀਆਂ ਉੱਭਰਦੀ ਗਈ ਪੰਜਾਬੀ ਜਿਹੜੀ ਭਾਸ਼ਾ ਗੀ ਫਿਰ ਗੁਰੂ ਸਾਹਿਬ ਨੇ ਕੀ ਹੈਗਾ ਆਪਣੇ ਗੁਰੂ ਸਾਹਿਬਾਂ ਗੁਰੂ ਸਾਹਿਬਾਨਾਂ ਨੇ ਫਿਰ ਉਹਨਾਂ ਨੇ ਗੁਰਮੁਖੀ ਲਿਪੀ ਦਾ ਗੁਰਮੁਖੀ ਲਿਪੀ ਦੀ ਸ਼ੁਰੂਆਤ ਕੀਤੀ ਤਾਂ ਅੱਜ ਕੀ ਜਿਹੜੀ ਜਿਹੜੀ ਵੀ ਆਪਾਂ ਪੰਜਾਬੀ ਬੋਲੀ ਬੋਲਦੇ ਹਾਂ ਜਾਂ ਸੁਣਦੇ ਹਾਂ ਹੈ ਨਾ ਜੋ ਵੀ ਆਪਾਂ ਲਿਖਦੇ ਆਗੇ ਇਹ ਕੀ ਆ ਅੱਜ ਉਸੇ ਦਾ ਹੀ ਰੂਪ ਆ ਉਹੀ ਰੂਪ ਆ ਜਿਹੜਾ ਆਪਾਂ ਵਰਤ ਰਹੇ ਆਗੇ ਵੀ ਪੰਜਾਬੀ ਲਿਪੀ ਹੈ ਨਾ ਜਿਹੜੀ ਇਹ ਇਹ ਟਾਈਮ ਦੇ ਸਮੇਂ ਦੇ ਨਾਲ ਕੀ ਆ ਬਹੁਤ ਸਾਰੀ ਤਬਦੀਲੀ ਆ ਗਈਆਂ ਜਿਵੇਂ ਤੁਸੀਂ ਕਹਿ ਲਓ ਜਿਵੇਂ ਹੁਣ ਪੰਜਾਬ ਦੇ ਹੈ ਨਾ ਵੀ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ 'ਚ ਜਿਹੜੀ ਇਹੀ ਜਿਹੜੀ ਗੁਰਮੁਖੀ ਲਿਪੀ ਆ ਉਹ ਅਲੱਗ ਅਲੱਗ ਲਹਿਜ਼ੇ 'ਚ ਬੋਲੀ ਜਾਂਦੀ ਹੈਗੀ ਜੇ ਆਪਾਂ ਪਹਾੜੀ ਏਰੀਏ ਦੀ ਗੱਲ ਕਰੀਏ ਤਾਂ ਉਹ ਹੋਸ ਹੋਰ ਤਰੀਕੇ ਨਾਲ ਗੱਲ ਕਰਦੇ ਨੇ ਮਾਝੀ ਜਿਵੇਂ ਹੁਣ ਇਲਾਕਿਆਂ ਦੇ ਹਿਸਾਬ ਨਾਲ ਆਪਾਂ ਕਹਿ ਦਈਏ ਉਪਭਾਸ਼ਾ ਜਿਹੜੀ ਹੈਗੀ ਉਹ ਉਹਦੇ ਕਰਕੇ ਫਰਕ ਪੈ ਗਿਆ ਜਿਹੜਾ ਬੋਲਣ ਦਾ ਜਿਹੜਾ ਲਹਿਜ਼ਾ ਹੈਗਾ ਵੀ ਜਿਵੇਂ ਹੁਣ ਮਾਲਵਾ ਜਿਹੜਾ ਮ ਮਲਵਈ ਇਲਾਕੇ ਮਾਲਵੇ ਇਲਾਕੇ ਦੇ ਵਿੱਚ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਮਾਝੇ ਦੇ ਵਿੱਚ ਮਾਝੀ ਬੋਲੀ ਜਾਂਦੀ ਹੈ ਇਸ ਤਰ੍ਹਾਂ ਜਿਵੇਂ ਜਿਵੇਂ ਆਪਾਂ ਇਲਾਕੇ ਬਦਲਦੇ ਆ ਤਾਂ ਉੱਥੇ ਜਿਹੜਾ ਲੋਕਾਂ ਨੇ ਕੀ ਆਪਦੇ ਉਹਦੇ ਸ ਆਪਦੀ ਮਤਲਬ ਕਿ ਆਪਦੀ ਆਪਾਂ ਲੋੜ ਅਨੁਸਾਰ ਕਹਿ ਸਕਦੇ ਆਂ ਉਹਨਾਂ ਨੇ ਕੀ ਹੈ ਲਹਿਜ਼ਾ ਬਦਲ ਤਾ ਅਤੇ ਤਾਂ ਕਰਕੇ ਮਤਲਬ ਇਹ ਜਿਵੇਂ ਹੁਣ ਆਪਾਂ ਕਹਿ ਦਈਏ ਨਾ ਬ ਜਿਵੇਂ ਹੁਣ ਇੱਕ ਪੰਜਾਬੀ ਸ਼ਬਦ ਹੈਗਾ ਸਾਈਕਲ ਹੈ ਨਾ ਵੀ ਉਹਦਾ ਇੱਕ ਪੰਜਾਬੀ ਅਨੁਵਾਦ ਹੀ ਨਹੀਂ ਹੈਗਾ ਆਪਾਂ ਉਹਨੂੰ ਸਾਈਕਲ ਹੀ ਬੋਲਦੇ ਹੈਗੇ ਹੈ ਨਾ ਵੀ ਇਸ ਤਰ੍ਹਾਂ ਵੀ ਬਹੁਤ ਸਾਰੇ ਜਿਹੜੇ ਸ਼ਬਦ ਨੇ ਹੈ ਨਾ ਜਿਹੜੇ ਆਪਾਂ ਉਵੇਂ ਦੇ ਉਵੇਂ ਹੀ ਵਰਤ ਰਹੇ ਹੈਗੇ ਵੀ ਤਾਂ ਕਰਕੇ ਹੌਲੀ ਹੌਲੀ ਕੀ ਕੁਝ ਨਾ ਕੁਝ ਡੇਲੀ ਹੈ ਨਾ ਡੇਲੀ ਰੋਜ਼ਾਨਾ ਦਰ ਦਰਮਿਆਨ ਹੈ ਨਾ ਮਤਲਬ ਕਿ ਉਹਦੇ ਵਿੱਚ ਰੋਜ਼ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ ਤਾਂ ਜਿਹੜਾ ਜਿਹੜਾ ਮੁੱਖ ਤਬਦੀਲੀ ਇਹੀ ਹੈ ਕਿ ਆਪਣਾ ਬੋਲਣ ਦਾ ਜਿਹੜਾ ਲਹਿਜ਼ਾ ਹੈ ਉਹ ਬਦਲ ਚੁੱਕਿਆ ਹੈਗਾ ਜੀ ਹੁਣ ਅੱਜ ਆਪਾਂ ਆਪਣੇ ਪੰਜਾਬ ਦੇ ਵਿੱਚ ਇਧਰ ਆਪਣੇ ਬੋਲੀ ਜਾਂਦੀ ਗੁਰਮੁਖੀ ਲਿਪੀ ਤਾਂ ਜਿਵੇਂ ਉਹੀ ਜਿਹੜੀ ਲਿਪੀ ਸੀਗੀ ਉੱਧਰ ਪਾਕਿਸਤਾਨ ਦੇ ਵਿੱਚ ਜਿਵੇਂ ਸ਼ਾਹਮੁਖੀ ਲਿਪੀ ਬੋਲੀ ਜਾਂਦੀ ਹੈਗੀ ਤਾਂ ਉਹਨਾਂ ਨੇ ਕੀ ਆ ਮਤਲਬ ਕਿ ਇੱਕ ਅੱਗੇ ਗਾਹਾਂ ਸਭ ਆਪਾਂ ਕਹਿ ਦਿੰਦੇ ਹਾਂ ਵੀ ਅੱਗੇ ਵੰਡਤੀਆਂ ਹੈ ਨਾ ਲਿਪੀਆਂ ਨੂੰ ਤਾਂ ਜਿਹੜੀ ਬਸ ਆਹੀ ਜਿਹੜੀ ਮੁੱਖ ਤਬਦੀਲੀ ਹੈਗੀ ਵੀ ਆਪਣਾ ਲਹਿਜ਼ਾ ਜਿਹੜਾ ਬੋਲਣ ਦਾ ਉਹ ਬਦਲ ਚੁੱਕਿਆ